ਟੈਕਨੋਲਜੀ ਆਉਣ ਨਾਲ ਬੱਚਿਆਂ ਦੇ ਜਿਹੜੀ ਸਿੱਖਿਆ ਪੱਧਰ ਹੈ ਬਹੁਤ ਹੀ ਉੱਚਾ ਉੱਠਿਆ ਹੈ ਕਿਉਂਕਿ ਜਦੋਂ ਆਪਾਂ ਪੜਾਉਂਦੇ ਹਾਂ ਤਾਂ ਬੱਚਿਆਂ ਦਾ ਧਿਆਨ ਇੱਧਰ ਉਧਰ ਹੁੰਦਾ ਹੈ ਅਤੇ ਔਨਲਾਈਨ ਕਲਾਸਾਂ ਲਗਾਣ ਨਾਲ ਅਤੇ ਵੀਡੀਓਜ਼ ਵਗੈਰਾ ਦੇਖਣ ਨਾਲ ਜੋ ਬੱਚੇ ਨੂੰ ਪੜਾਇਆ ਜਾਂਦਾ ਉਸ ਤੋਂ ਵੱਧ ਜਿਆਦਾ ਉਹ ਦੇਖ ਕੇ ਸਿੱਖ ਲੈਂਦੇ ਹਨ ਇਸ ਤਰ੍ਹਾਂ ਨਾਲ ਟੈਕਨੋਲਜੀ ਨੇ ਸਿੱਖਿਆ ਪੱਧਰ ਨੂੰ ਬਹੁਤ ਹੀ ਉੱਚਾ ਚੁੱਕਿਆ ਹੈ